ਮੈਂ ਆਪਣੇ ਲਈ ਓਨਲਾਈਨ ਤੋਂ ਯੂਸਰ ਮੰਗਾਇਆ ਸੀਗਾ ਜਿਹੜਾ ਕਿ ਕਾਫੀ ਦਿਨ ਹੋ ਗਏ ਸੀਗੇ ਮੈਨੂੰ ਅਜੇ ਤੱਕ ਮਿਲਿਆ ਨਹੀਂ ਸੀਗਾ ਅਤੇ ਮੈਨੂੰ ਕੁਝ ਸਮਝ ਵੀ ਨਹੀਂ ਸੀ ਆ ਰਹੀ ਵੀ ਮੈਂ ਜਿਹੜਾ ਆਰਡਰ ਪਾਇਆ ਵੀ ਉਹ ਆਮ ਮਿਲੇਗਾ ਵੀ ਕਿ ਨਹੀਂ ਮਿਲੇਗਾ ਅਤੇ ਇਸ ਚੱਕਰ ਵਿੱਚ ਮੈਂ ਐਮਜੋਨ ਦੇ ਹੈਲਪਲਾਈਨ ਵਿੱਚ ਫੋਨ ਕਰਕੇ ਉਹਨਾਂ ਦੀ ਮਦਦ ਲਈ ਅਤੇ ਉਹਨਾਂ ਤੋਂ ਪੁੱਛਿਆ ਮੈਂ ਵੀ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਫੋਨ 'ਤੇ ਟਰੈਕ ਨਹੀਂ ਆ ਰਿਹਾ ਅਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਤੁਸੀਂ ਆਪਣੇ ਫੋਨ ਨੂੰ ਵੀ ਕਿਸੇ ਦਿੱਕਤ ਦੀ ਵਜ੍ਹਾ ਦੇ ਕਰਕੇ ਲੇਟ ਹੋ ਗਿਆ ਸੀਗਾ ਅਤੇ ਹੁਣ ਤੁਸੀਂ ਆਪਣੇ ਫੋਨ ਦਾ ਰਿਸੈਟ ਕਰਕੇ ਦੁਬਾਰਾ ਦੇਖੋ ਤੁਹਾਨੂੰ ਉਹਦੀ ਲੋਕੇਸ਼ਨ ਵਗੈਰਾ ਖੋਲ੍ਹ ਕੇ ਦੇਖੋ ਅਤੇ ਤੁਹਾਨੂੰ ਦੋ ਚਾਰ ਦਿਨਾਂ ਤੱਕ ਉਹ ਚੀਜ਼ ਤੁਹਾਡੇ ਤੱਕ ਪਹੁੰਚ ਜਾਏਗੀ